ਸਾਡੇ ਆਮ ਰਵਾਇਤੀ ਪਕਵਾਨ ਕਈ ਤਰ੍ਹਾਂ ਦੇ ਹਨ ਜਿਸ ਵਿੱਚ ਗੁਲਗੁਲੇ ਕਚੋਰੀਆਂ ਖੀਰ ਪੂੜੇ ਲੱਡੂ ਜਲੇਬੀਆਂ ਸ਼ੱਕਰਪਾਰੇ ਖੁਰਮੇ ਪਕੌੜੇ ਜਲੇਬੀਆਂ ਇਹ ਇਸ ਤਰ੍ਹਾਂ ਦੇ ਪਕਵਾਨ ਆਉਂਦੇ ਹਨ ਖੀਰ ਪੂੜੇ ਜੋ ਕਿ ਸਾਉਣ ਦੇ ਮਹੀਨੇ ਵਿੱਚ ਬਣਦੇ ਹਨ ਅਤੇ ਲੱਡੂ ਸ਼ੱਕਰਪਾਰੇ ਖੁਰਮੇ ਇਹ ਮੇਨਲੀ ਵਿਆਹਾਂ 'ਚ ਬਣਦੇ ਹਨ ਅਤੇ ਇਹ ਹੁਣ ਲੋਕਾਂ ਦਾ ਰਵੱਈਆ ਇਹਨਾਂ ਵੱਲ ਘੱਟ ਘੱਟ ਰਿਹਾ ਹੈ ਹੁਣ ਹੋਰ ਤਰ੍ਹਾਂ ਦੇ ਪਕਵਾਨ ਆ ਚੁੱਕੇ ਹਨ ਜਿਵੇਂ ਕਿ ਪੀਜ਼ਾ ਪੇਸਟਰੀਆਂ ਉਹਨਾਂ ਵੱਲ ਲੋਕਾਂ ਦਾ ਰੁਝਾਨ ਜ਼ਿਆਦਾ ਵੱਧ ਰਿਹਾ ਹੈ